ਸਤਿ ਸ਼੍ਰੀ ਅਕਾਲ ਸਰ ਮੈਂ ਤੁਹਾਡੇ ਔਨਲਾਈਨ ਸਟੋਰ ਤੋਂ ਵਾਇਰਲੈੱਸ ਹੈੱਡਫੋਨ ਦੀ ਇੱਕ ਜੋੜੀ ਮੰਗਵਾਈ ਹੈ ਜਿਸ ਦਾ ਰੰਗ ਮੈਂ ਕਾਲਾ ਮੰਗਵਾਇਆ ਹੈ ਪਰ ਮੈਨੂੰ ਹੁਣ ਉਲਝਣ ਹੈ ਕਿ ਤੁਹਾਡੇ ਦੁਆਰਾ ਕਈ ਰੰਗਾਂ ਦੇ ਵਿਕਪਲ ਦਿੱਤੇ ਗਏ ਸਨ ਆਡਰ ਕਰਦੇ ਵਕਤ ਮੈਂ ਵੀ ਜਲਦਬਾਜੀ ਵਿੱਚ ਸੀ ਇਸ ਕਰਕੇ ਮੈਨੂੰ ਪੁਸ਼ਟੀ ਨਹੀਂ ਹੋ ਪਾ ਰਹੀ ਕਿ ਮੈਂ ਕਿਹੜਾ ਰੰਗ ਮੰਗਵਾਇਆ ਹੈ ਅਤੇ ਮੇਰਾ ਚੁਣਿਆ ਗਿਆ ਰੰਗ ਸਹੀ ਹੈ ਜਾਂ ਨਹੀਂ ਇਸ ਲਈ ਮੈਂ ਤੁਹਾਡੇ ਗ੍ਰਾਹਕ ਸੇਵਾ ਨੂੰ ਇਹ ਈਮੇਲ ਭੇਜ ਰਿਹਾ ਹਾਂ ਇਸ ਵਿੱਚ ਮੈਨੂੰ ਪੁਸ਼ਟੀ ਕਰ ਦਿਓ ਕਿ ਮੇਰੇ ਦੁਆਰਾ ਚੁਣਿਆ ਗਿਆ ਵਿਕਲਪ ਕਿਹੜਾ ਹੈ ਤਾਂ ਜੋ ਮੈਂ ਆਪਣੀ ਉਲਝਣ ਨੂੰ ਦੂਰ ਕਰ ਸਕਾਂ ਅਤੇ ਤੁਹਾਡਾ ਬਹੁਤ ਧੰਨਵਾਦ ਹੋਵੇਗਾ